ਸਾਡੇ ਇਲਾਕੇ ਵਿੱਚ ਬਹੁਤ ਹੀ ਘੁੰਮਣਯੋਗ ਮਨਪਸੰਦ ਥਾਵਾਂ ਹਨ ਜਿਵੇਂ ਕਿ ਅਸੀਂ ਦੱਸ ਦੇਈਏ ਕਿ ਅਸੀਂ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹਾਂ ਉੱਥੇ ਇੱਕ ਆਮ ਖ਼ਾਸ ਬਾਗ ਬਣਿਆ ਹੋਇਆ ਹੈ ਜੋ ਕਿ ਮੁਗਲਾਂ ਦੇ ਟਾਈਮ ਤੋਂ ਬਣਿਆ ਹੋਇਆ ਹੈ ਜਿੱਥੇ ਦੀ ਜਿੱਥੋਂ ਦਾ ਆਰਟੀਟੈਚਰ ਇੰਨਾਂ ਵਧੀਆ ਹੈ ਕਿ ਆਪਾ ਸੋਚ ਵੀ ਨਹੀਂ ਸਕਦੇ ਅਤੇ ਅਸੀਂ ਉੱਥੇ ਫੋਟੋਆਂ ਖਿਚਾਉਣ ਜਾਂਦੇ ਹਾਂ ਅਤੇ ਸਾਨੂੰ ਚੰਡੀਗੜ੍ਹ ਵੀ ਤੀਹ ਕਿਲੋਮੀਟਰ ਪੈਂਦਾ ਹੈ ਜਿੱਥੇ ਕਿ ਰੋਜ਼ ਗਾਰਡਨ ਬਣਿਆ ਹੋਇਆ ਹੈ ਜਿੱਥੇ ਕਿ ਰੋਜ਼ ਗਾਰਡਨ ਦੇ ਵਿੱਚ ਵੱਖ ਵੱਖ ਪੰਜ ਸੌ ਪ੍ਰਕਾਰ ਦੇ ਫੁੱਲਾਂ ਦੀ ਵਰਾਇਟੀ ਹੈ ਲੋਕ ਇਸ ਨੂੰ ਦੇਖਣ ਲਈ ਦੂਰੋਂ ਦੂਰੋਂ ਆਉਂਦੇ ਹਨ ਇਸ ਦੇ ਨਾਲ ਹੀ ਇੱਥੇ ਰੌਕ ਗਾਰਡਨ ਵੀ ਬਣਿਆ ਹੋਇਆ ਹੈ ਜੋ ਕਿ ਟੁੱਟੇ ਫੁੱਟੇ ਪੱਥਰਾਂ ਕੱਚ ਵਗੈਰਾ ਉਨ੍ਹਾਂ ਦੀ ਕਾਰਾਗੀਰੀ ਕਰਕੇ ਉਨ੍ਹਾਂ ਨਾਲ ਬਣਾਇਆ ਗਿਆ ਹੈ ਜੋ ਕਿ ਬਹੁਤ ਪ੍ਰਭਾਵਸ਼ਾਲੀ ਹੈ ਲੋਕਾਂ ਦੇ ਦੇਖਣ 'ਤੇ ਬਹੁਤ ਆਕਰਸ਼ਿਤ ਹੁੰਦਾ ਹੈ ਅਤੇ ਇੱਥੇ ਸੁਖਨਾ ਝੀਲ ਵੀ ਹੈ ਜੋ ਕਿ ਪੁਰਾਣੇ ਟਾਈਮ ਤੋਂ ਇੱਥੇ ਹਾਥੀ ਟਹਿਲਿਆ ਕਰਦੇ ਸਨ